ਨਮਸਤੇ ਮੈਮ ਤੁਸੀਂ ਕੌਣ ਹਾਂਜੀ ਅੱਛਾ ਉਹਨੂੰ ਕੀ ਹੋਇਆ ਮੈਡਮ ਉਹ ਤਾਂ ਥੋੜ੍ਹੀ ਦੇਰ ਪਹਿਲੇ ਠੀਕ ਹੀ ਗਈ ਸੀ ਘਰੋਂ ਠੀਕ ਆ ਮੈਡਮ ਮੈਂ ਇਹਨਾਂ ਦੇ ਪਾਪਾ ਬਾਹਰ ਹੀ ਹਨ ਅਤੇ ਮੈਂ ਉਹਨਾਂ ਨੂੰ ਕਹਿੰਦੀ ਹਾਂ ਕਿ ਉਹ ਉਹਨੂੰ ਸਕੂਲੋਂ ਆ ਕੇ ਲੈ ਜਾਣਗੇ ਧੰਨਵਾਦ